ਮੈਂ ਜਿਹੜੇ ਕਾਲਜ ਕੰਮ ਕਰਦੀ ਹਾਂ ਸਾਡਾ ਕਾਲਜ ਗਰੁੱਪ ਆਫ ਇੰਸਟਿਊਸ਼ਨ ਹੈ ਕਿ ਸਾਡੇ ਨਾਲ ਹੋਰ ਵੀ ਕਈ ਸੰਸਥਾਵਾਂ ਹਨ ਜਿਵੇਂ ਨਰਸਿੰਗ ਕਾਲਜ ਐਜੂਕੇਸ਼ਨ ਕਾਲਜ ਫਾਰਮੇਸੀ ਕਾਲਜ ਸਕੂਲ ਹੈ ਅਤੇ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਸਾਨੂੰ ਸਮੇਂ ਸਮੇਂ 'ਤੇ ਸਾਰੇ ਦੂਜੀਆਂ ਸੰਸਥਾਵਾਂ ਦੇ ਵਿੱਚ ਜਾ ਕੇ ਕੋਈ ਨਾ ਕੋਈ ਨਵਾਂ ਕੰਮ ਕੋਈ ਪ੍ਰੋਜੈਕਟ ਕਰਨ ਦੇ ਵਾਸਤੇ ਸਾਨੂੰ ਦਿੰਦੇ ਹਨ ਅਤੇ ਇਸ ਤਰ੍ਹਾਂ ਹੀ ਮੈਨੂੰ ਇੱਕ ਵਾਰੀ ਮੈਨੂੰ ਮੇਰੇ ਮੈਨੇਜਮੈਂਟ ਨੇ ਮੈਨੂੰ ਪ੍ਰੋਜੈਕਟ ਦਿੱਤਾ ਕਿ ਸਾਡੀ ਆਯੁਰਵੈਦਿਕ ਕਾਲਜ ਜੋ ਸੀ ਉੱਥੋਂ ਦੇ ਕਿਸੇ ਬਾਹਰੋਂ ਟੀਮ ਨੇ ਆਉਣਾ ਸੀ ਅਤੇ ਮੇਰਾ ਪ੍ਰੋਜੈਕਟ ਇਹ ਸੀ ਕਿ ਉਸ ਟੀਮ ਦੇ ਅੱਗੇ ਮੈਂ ਸਾਰੇ ਆਯੁਰਵੈਦਿਕ ਦਾ ਜੋ ਵੀ ਉਹਨਾਂ ਦਾ ਡੇਲੀ ਕੰਮ ਹੈ ਕਿਹੜੇ ਬੱਚੇ ਆਉਂਦੇ ਹਨ ਉਹਨਾਂ ਬੱਚਿਆਂ ਦਾ ਕੀ ਸਿਲੇਬਸ ਹੈ ਜਾਂ ਬੱਚਿਆਂ ਦੀ ਕੀ ਅਟੈਂਡੈਂਸ ਹੈ ਬੱਚਿਆਂ ਦਾ ਵਰਕਿੰਗ ਕੀ ਹੈ ਬੱਚੇ ਡੇਲੀ ਕਿੰਨੇ ਆਉਂਦੇ ਹਨ ਅਤੇ ਉਹਨਾਂ ਦਾ ਸਾਰੇ ਇਹਦੇ ਬਾਰੇ ਮੈਨੂੰ ਸਾਰੀ ਜਿਹੜੀ ਜਾਣਕਾਰੀ ਉਹਨਾਂ ਨੂੰ ਮੈਂ ਟੀਮ ਨੂੰ ਦੇਣੀ ਸੀ ਅਤੇ ਮੈਨੂੰ ਪਹਿਲਾਂ ਤਾਂ ਲੱਗਿਆ ਕਿ ਨਹੀਂ ਕਿਉਂਕਿ ਮੇਰੀ ਜਿਹੜੀ ਆਪਣੀ ਮੇਰੀ ਮੇਰੀ ਐਜੂਕੇਸ਼ਨ ਹੈ ਜਾਂ ਜੋ ਮੇਰੀ ਜੋਬ ਹੈ ਉਹ ਤਾਂ ਮੇਰੀ ਹੈ ਕਿ ਡਿਗਰੀ ਕਾਲਜ ਦੇ ਨਾਲ ਜਿਹਦੇ ਵਿੱਚ ਸੇ ਸਾਡਾ ਬੀ ਏ ਦੇ ਨਾਲ ਸਬੰਧ ਬੀ ਸੀ ਏ ਦੇ ਨਾਲ ਬੀ ਕੌਮ ਦੇ ਨਾਲ ਪਰ ਜਿਹੜਾ ਆਯੁਰਵੈਦਿਕ ਦਾ ਕੰਮ ਸੀ ਜਿਹੜੀ ਇਹ ਜੋਬ ਸੀ ਇ ਇਸ ਸਾਈਡ ਜਿਹੜੇ ਤੁਹਾਨੂੰ ਵੀ ਪਤਾ ਹੈ ਕਿ ਆਯੁਰਵੈਦਿਕ ਦਵਾਈਆਂ ਦਾ ਕੰਮ ਕਿਵੇਂ ਐਜੂਕੇਸ਼ਨ ਤੋਂ ਟੋਟਲੀ ਦੂਜੇ ਪਾਸੇ ਦਾ ਕੰਮ ਪਰ ਮੈਂ ਬੜੀ ਇਹ ਐਡੇ ਵੱਡੇ ਚੁਣੌਤੀਪੂਰਨ ਕੰਮ ਨੂੰ ਜਿਹੜਾ ਸੀ ਮੇਰੇ ਵਾਸਤੇ ਉਸ ਵੇਲੇ ਚੈਲੇਂਜ ਲੱਗ ਰਿਹਾ ਸੀ ਕਿਵੇਂ ਮੈਂ ਟੀਮ ਦੇ ਅੱਗੇ ਸਾਰਾ ਕੁਛ ਪੇਸ਼ ਕਰਾਂਗੀ ਪਰ ਬੜਾ ਈਜ਼ੀਲੀ ਮੈਂ ਜੋ ਵੀ ਉਹਨਾਂ ਦੇ ਮੈਡੀਸਨ ਦੇ ਬਾਰੇ ਆਯੁਰਵੈਦਿਕ ਜੋ ਇਹ ਸਾਈਡ ਸੀ ਇਹ ਖੇਤਰ ਸੀ ਇਹਦੇ ਬਾਰੇ ਮੈਂ ਸਾਰਾ ਕੁਝ ਉਹਨਾਂ ਨੂੰ ਬੜਾ ਇਜੀਲੀ ਦੱਸ ਦਿੱਤਾ ਸਾਰੇ ਬੱਚਿਆਂ ਦੇ ਬਾਰੇ ਕਿੰਨੇ ਆਉਂਦੇ ਕਿ ਕਿਵੇਂ ਬੱਚੇ ਜਿਹੜੇ ਡੇਲੀ ਆਪਣੀ ਵਰਕਿੰਗ ਕਰ ਰਹੇ ਹਨ ਕਿਵੇਂ ਉਹਨਾਂ ਦੇ ਪ੍ਰੈਕਟੀਕਲ ਹੁੰਦੇ ਹਨ ਸਾਰੇ ਬਾਰੇ ਮੈਂ ਉਹਨਾਂ ਨੂੰ ਬੜੇ ਛੇਤੀ ਅਤੇ ਬੜੇ ਥੋੜ੍ਹੇ ਲਫਜ਼ਾਂ ਦੇ ਵਿੱਚ ਸਾਰੀ ਜਾਣਕਾਰੀ ਦੇ ਦਿੱਤੀ